ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਟੈਕਨੋਲਜੀ ਬਹੁਤ ਵੱਧ ਗਈ ਹੈ ਪੰਜਾਬ ਵਿੱਚ ਟੈਕਨੋਲਜੀ ਦੇ ਖੇਤਰ ਵਿੱਚ ਬਹੁਤ ਬਹੁਤ ਵਾਧਾ ਹੋਇਆ ਹੈ ਇਸ ਦੇ ਜ ਇਸਨੇ ਇਸ ਟੈਕਨੋਲਜੀ ਨੇ ਜਿੱਥੇ ਸਾਡੇ ਬਹੁਤ ਸਾਨੂੰ ਲਾਭ ਦਿੱਤੇ ਹਨ ਉੱਥੇ ਸਾ ਸਾਡੇ ਵਾਤਾਵਰਣ ਅਤੇ ਸਮਾਜਿਕ ਸਮਾਜ ਨੂੰ ਵੀ ਪ੍ਰਭਾਵਿਤ ਕੀਤਾ ਹੈ ਜਿਵੇਂ ਕਿ ਅਸੀਂ ਕਹਿ ਸਕਦੇ ਹਾਂ ਕਿ ਜਿਸ ਤਰ੍ਹਾਂ ਮੋਬਾਈਲ ਜੋ ਹੈ ਮੋਬਾਈਲ ਸਾਡੇ ਲਈ ਬਹੁਤ ਉ ਬਹੁਤ ਹੀ ਉਪਯੋਗੀ ਹੈ ਅਤੇ ਇਸ ਨਾਲ ਅਸੀਂ ਬਹੁਤ ਜ਼ਿਆਦਾ ਦੂਰ ਦੂਰ ਦਰਾਜ ਵਾਲੇ ਲੋਕਾਂ ਨਾਲ ਬਹੁਤ ਆਸਾਨੀ ਨਾਲ ਇੱਕ ਮਿੰਨਟ ਵਿੱਚ ਵੀ ਗੱਲ ਕਰ ਲੈਂਦੇ ਹਾਂ ਸਾਨੂੰ ਇਸ ਦੇ ਬਹੁਤ ਫ਼ਾਇਦੇ ਹਨ ਪਰ ਜੋ ਇਸ ਦੇ ਟਾ ਟਾਵਰ ਲਗਾਏ ਗਏ ਹਨ ਜਿਸ ਨਾਲ ਪੰਸ਼ੂ ਪਸ਼ੂ ਪੰਛੀ ਦਾ ਬਹੁਤ ਨੁਕਸਾਨ ਹੋਇਆ ਹੈ ਪੰਛੀ ਤਾਂ ਬਿਲਕੁਲ ਖਤਮ ਹੀ ਹੋ ਗਏ ਹਨ ਇਸ ਦੇ ਬਹੁਤ ਨੁਕਸਾਨ ਵੀ ਹਨ ਜੇ ਟੈਕਨੋਲੇਜੀ ਸਾਡੇ ਲਈ ਲਾਭ ਵਾਲੀ ਹੈ ਤਾਂ ਉਹ ਸਾਡੇ ਵਾਸਤੇ ਨੁਕਸਾਨ ਵਾਲੀ ਵੀ ਬਹੁਤ ਹੈ ਹਰ ਖੇਤਰ ਚਾਹੇ ਉਹ ਕ ਕਿਸਾਨਾਂ ਲਈ ਅਲੇਕ ਮਤ ਅਨੇਕ ਤਰ੍ਹਾਂ ਦੀਆਂ ਮਸ਼ੀਨਾਂ ਹੋਵਣ ਭਾਵੇਂ ਸਕੂਲ ਸਕੂਲ ਤੇਸ਼ ਅਤੇ ਦੁਕਾਨਾਂ ਦੇ ਕੰਪਿਊਟਰ ਹੋਣ ਜੇ ਇਹਨਾਂ ਦਾ ਦੁਕਾਨ ਵਾਲਿਆਂ ਨੂੰ ਸਕੂਲ ਵਾਲਿਆਂ ਨੂੰ ਫ਼ਾਇਦੇ ਵੀ ਹਨ ਕਿ ਉਹ ਆਪਣਾ ਹਰ ਤਰ੍ਹਾਂ ਦਾ ਡਾਟਾ ਜੋ ਹੈ ਉਸ ਵਿੱਚ ਰੱਖ ਸਕਦੇ ਹਨ ਪਰ ਇਨ੍ਹਾਂ ਚੀਜ਼ਾਂ ਦਾ ਨੁਕਸਾਨ ਵੀ ਬਹੁਤ ਹੋ ਰਿਹਾ ਹੈ ਜਿਵੇਂ ਕਿ ਬੱਚੇ ਮੋਬਾਈਲ 'ਚ ਬਹੁਤ ਜ਼ਿਆਦਾ ਬਿਜ਼ੀ ਰਹਿਣ ਲੱਗ ਲੱਗ ਪਏ ਹਨ ਉਹ ਹੈ ਆਪਣੇ ਖੇਡਾਂ ਬਨੀ ਧਿਆਨ ਨਾ ਦੇ ਕੇ ਮੋਬਾਈਲ ਵਿੱਚ ਹੀ ਰਹਿਣ ਲੱਗ ਪਏ ਹਨ ਇਸ ਲਈ ਸਾਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਟੈਕਨੋਲਜੀ ਅਗਰ ਸਾਡੇ ਵਾਸਤੇ ਵਧੀਆ ਹੈ ਤਾਂ ਖ਼ਰਾਬ ਵੀ ਹੈ